ਹਾਂਜੀ ਹਾਂਜੀ ਸਰ ਹਾਂਜੀ ਸਰ ਕੰਪਿਊਟਰ ਦੀ ਦੁਕਾਨ ਹਾਂਜੀ ਸਰ ਬੋਲੀਏ ਕਿਆ ਸੇਵਾ ਕਰ ਸਕਦੇ ਆਪਾਂ ਹਾਂਜੀ ਓਕੇ ਠੀਕ ਹੈ ਠੀਕ ਹੈ ਸਰ ਕਿੰਨੀ ਕਿੰਨੀ ਦੇਰ ਪੁਰਾਣਾ ਸਰ ਕਿੰਨੀ ਦੇਰ ਦੋ ਸਾਲ ਪੁਰਾਣਾ ਤਿੰਨ ਸਾਲ ਪੁਰਾਣਾ ਠੀਕ ਹੈ ਸਰ ਓਕੇ ਸਰ ਹਾਂਜੀ ਓਕੇ ਸਰ ਦੇਖੋ ਜਨਰੇਸ਼ਨ ਏਟ ਦਾ ਜਮਾਨਾ ਹੈ ਸਰ ਹੁਣ ਤਾਂ ਵੈਸੇ ਤਾਂ ਆਪਾਂ ਵਿੰਡੋ ਸੈਵਨ ਵੀ ਕਰ ਦਿਆਂਗੇ ਜੋ ਕੰਪਿਊਟਰ 'ਤੇ ਰਿਲਾਏਬਿਲਟੀ ਹੋਏਗੀ ਉਸ ਟਾਈਮ ਦੀ ਸਰ ਠੀਕ ਹੈ ਸੋਫਟਵੇਅਰ ਵੀ ਕਰ ਦਿਆਂਗੇ ਤੁਹਾਡਾ ਜੋ ਵੀ ਤੁਹਾਨੂੰ ਰਿਕੁਐਰਮੈਂਟ ਹੈਗੀਆਂ ਨੇ ਜਿਹੜੇ ਜਿਹੜੇ ਟੈਲੀ ਕਰ ਦਿਆਂਗੇ ਕੋਈ ਜੋ ਵੀ ਤੁਹਾਡੇ ਰਿਕੁਐਰਮੈਂਟਸ ਹੈ ਓਫਿਸ ਕਰ ਦਿਆਂਗੇ ਜੋ ਬੇਸਿਕਲੀ ਯੂਜਸ ਹੁੰਦੀਆਂ ਨੇ ਜਿਹਦੇ 'ਚ ਠੀਕ ਹੈ ਅਤੇ ਮਿਊਜੀਕਲ ਵੀ ਹਾਂਜੀ ਦੇਖ ਲਵਾਂਗੇ ਕੋਈ ਗੱਲ ਨਹੀਂ ਉਸ ਹਿਸਾਬ ਤੁਹਾਡੇ ਜਿੰਨੇ ਵੀ ਸੋਫਟਵੇਅਰ ਦੀ ਰਿਕੁਐਰਮੈਂਟ ਹੈ ਕਰ ਦਿਆਂਗੇ ਸਰ ਕੋਈ ਚੱਕਰ ਆਲੀ ਗੱਲ ਨਹੀਂ ਹੈ

ਹਾਂ ਦੇਖ ਲਾਂਗੇ ਸਰ ਨਹੀਂ ਤਾਂ ਫਿਰ ਤੁਹਾਨੂੰ ਨਵਾਂ ਦੇ ਦਿਆਂਗੇ ਕੰਪਿਊਟਰ ਇਹ ਰੱਖ ਕੇ ਨਵਾਂ ਦੇ ਦਿਆਂਗੇ ਕੋਈ ਚੱਕਰ ਨਹੀਂ ਹੈ ਸਰ ਪੁਰਾਣੇ ਵਾਲਾ ਰੱਖ ਲਵਾਂਗੇ ਨਵਾਂ ਦੇ ਦਿਆਂਗੇ ਨਵੀਂ ਜਨਰੇਸ਼ਨ ਨਾਲ ਦੇ ਦਿਆਂਗੇ ਤੁਹਾਡੇ ਵੀ ਬੜੇ ਨਾਲੇ ਹੁਣ ਆਲੇ ਰੇਟਾਂ 'ਚ ਦੇ ਦਿਆਂਗੇ ਬਹੁਤ ਸਸਤੇ 'ਚ ਸਰ ਹਾਂਜੀ ਬਿਲਕੁਲ ਸਹੀ ਵਧੀਆ ਬਣਾ ਕੇ ਦੇਵਾਂਗੇ ਸਰ ਕੋਈ ਚੱਕਰ ਆਲੇ ਕੋਈ ਕੰਪਲੇਂਟ ਦਾ ਮੌਕਾ ਨਹੀਂ ਦਵਾਂਗੇ ਤੁਹਾਨੂੰ ਅਤੇ ਵਧੀਆ ਚੀਜ਼ ਚੱਲੇਗੀ ਸਰ ਨਵੇਂ ਲੇਟੈਸਟ ਸਰ ਬਾਕੀ ਹਾਂਜੀ ਹਾਂਜੀ ਕੋਈ ਚੱਕਰ ਵਾਲੀ ਗੱਲ ਨਹੀਂ ਸਰ ਬਣਾ ਦਿਆਂਗੇ ਸਰ ਆਜੋ ਹਾਂਜੀ ਜਦੋਂ ਮਰਜ਼ੀ ਆਜੋ ਵੈਲਕਮ ਜਦੋਂ ਮਰਜ਼ੀ ਸਿਸਟਮ ਲੈ ਆਇਓ ਦੇਖ ਲਵਾਂਗੇ ਜੋ ਵੀ ਰਿਕੁਆਇਰਮੈਂਟਸ ਹੋਣਗੇ ਜੇ ਓਹੀ ਸਹੀ ਹੁੰਦਾ ਹੋਇਆ ਵਧੀਆ ਬਣਦਾ ਹੋਇਆ ਉਹੀ ਬਣਾ ਦਿਆਂਗੇ ਸਸਤੇ ਰੇਟਾਂ 'ਤੇ ਜੇ ਤੁਹਾਨੂੰ ਰੱਖ ਕੇ ਕਟਿੰਗ ਕਰਕੇ ਤੁਹਾਡੇ ਘੱਟ ਰੇਟਾਂ 'ਤੇ ਲਾ ਕੇ ਤੁਹਾਨੂੰ ਕੋਈ ਨਵਾਂ ਦੇ ਦਿਆਂਗੇ ਪੀਸੀ ਹਾਂਜੀ ਹਾਂਜੀ ਹਾਂਜੀ ਨਾਲ ਉਹਦੇ ਐੱਲਸੀਡੀ ਵਗੈਰਾ ਜੋ ਵੀ ਉਹਦੇ ਨਾਲ ਹੈ ਸਾਰਾ ਲੈ ਆਇਆ ਜੇ ਦੇਖ ਲਾਂਗੇ ਕੋਈ ਐੱਲਸੀਡੀ ਹੈ ਪੁਰਾਣੀ ਉਹ ਵੀ ਰੱਖ ਲਵਾਂਗੇ ਅਤੇ ਸੀਪੀਯੂ ਨਵਾਂ ਬਣਾ ਦਵਾਂਗੇ ਤੁਹਾਨੂੰ ਹਾਂਜੀ ਵਧੀਆ ਬਣਾ ਦਿਆਂਗੇ ਬਿਲਕੁਲ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ

ਹਾਂ ਹਾਂ ਨਹੀਂ ਨਹੀਂ ਸਰ ਉਹ ਕੋਈ ਚੱਕਰ ਵਾਲੀ ਗੱਲ ਨਹੀਂ ਸਰ ਕੰਪਲੇਂਟ ਦਾ ਕੋਈ ਮੌਕਾ ਨਹੀਂ ਦਵਾਂਗੇ ਤੁਹਾਨੂੰ ਕੋਈ ਚੱਕਰ ਵਾਲੀ ਗੱਲ ਨਹੀਂ ਜਦੋਂ ਮਰਜ਼ੀ ਆਓ ਤੁਸੀਂ ਹਾਂਜੀ ਹਾਂਜੀ ਜੋਬ ਵਗੈਰਾ ਕਰਦੇ ਜੀ ਕਿ ਆਪਣਾ ਫਾਰਮਰ ਦਾ ਕੰਮ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਹਮ ਹਮ ਹਮ ਹਮ ਉਹ ਤੁਹਾਡੇ ਵਰਕ ਦੇ ਸਾਹਿਬ ਨਾਲ ਵੇਖ ਲੈਣ ਕੀ ਰਿਕੁਐਰਮੈਂਟਸ ਹੈ ਚੀਜ਼ਾਂ ਜੇ ਬੱਚਿਆਂ ਨੇ ਯੂਜ ਕਰਨਾ ਤੁਹਾਡੇ ਬੱਚਿਆਂ ਵਾਸਤੇ ਉਸ ਸਾਹਿਬ ਨਾਲ ਟੈਕਨੋਲਜੀ ਦੇ ਸਾਹਿਬ ਨਾਲ ਆਪਾਂ ਫਿੱਟ ਕਰ ਦਵਾਂਗੇ ਸਾਰਾ ਕੁਛ ਹਮ ਹਮ ਹਮ ਹਮ ਐੱਚ ਡੀ ਐੱਚ ਡੀ ਕੁਆਲਟੀ ਆਲਾ ਦੇਵਾਂਗੇ ਤੁਹਾਨੂੰ ਐੱਚਪੀ ਕੰਪਨੀ ਦਾ ਡੈੱਲ ਦਾ ਐਸੂਸ ਦਾ ਤਿੰਨ ਚਾਰ ਕੰਪਨੀਆਂ ਆਪਣੇ ਕੋਲ ਜਿਵੇਂ ਤੁਹਾਨੂੰ ਸੁਟੇਬਲ ਲੱਗੇ ਓਵੇਂ ਦੇਖ ਲਿਆਜੇ ਤੁਸੀਂ ਠੀਕ ਹੈ ਨਾ ਜੀ ਠੀਕ ਹੈ ਜੀ ਓਕੇ